ਪਸ਼ੂਆਂ ਨੂੰ ਸਵੇਰੇ ਜਗਾਉਣਾ ਪਾਣੀ ਪਿਲਾਉਣਾ ਅਤੇ ਚਾਰੇ ਦੀ ਪਰਵਾਹੀ ਕਰਨਾ ਸਫਾਈ ਕਰਨਾ ਪਸ਼ੂਆਂ ਦੀ ਸਿਹਤ ਦੀ ਜਾਂਚ ਕਰਨੀ ਜਿਵੇਂ ਭੁੱਖ ਠੀਕ ਤਰ੍ਹਾਂ ਚਲਦੇ ਕਿ ਨਹੀਂ ਜਾਂ ਕੋਈ ਬਿਮਾਰੀ ਦੇ ਲੱਛਣ ਹੋਣ ਉਹਨਾਂ 'ਚ ਐਨ ਦੁਪਹਿਰੇ ਜਿੱਦਾਂ ਪਸ਼ੂਆਂ ਨੂੰ ਚ ਚਾਰੇ ਵਾਸਤੇ ਛੱਡਣਾ ਕੋਈ ਘਾਹ ਕਿਸੇ ਜਗ੍ਹਾ 'ਤੇ ਉਪਲਬਧ ਹੈ ਪਾਣੀ ਦੇ ਭਰਿਆਂ ਨੂੰ ਦੁਬਾਰਾ ਚੈੱਕ ਕਰਨਾ ਜੇ ਪਸ਼ੂ ਦੁੱਧ ਦੇਣ ਵਾਲੇ ਹੁੰਦੇ ਜਿੱਦਾਂ ਅਤੇ ਉਹਨਾਂ ਨੂੰ ਸਵੇਰੇ ਨਹੀਂ ਦੁਪਹਿਰੇ ਜਿੱਦਾਂ ਉਹਨਾਂ ਦੀ ਧਾਰ ਵਗੈਰਾ ਕੱਢਣੀ ਅਤੇ ਸ਼ਾਮ ਦੀ ਸੰਭਾਲ ਲਈ ਤਾਂ ਪਸ਼ੂਆਂ ਨੂੰ ਵਾਪਸ ਫਿਰ ਅੰਦਰ ਜਾ ਕੇ ਬੰਨ੍ਹਣਾ ਜਦੋਂ ਚਾਰਾ ਦੇਣਾ ਉਹਨਾਂ ਨੂੰ ਜਿੱਦਾਂ ਪੱਠੇ ਪਾਉਣੇ ਉਹਨਾਂ ਨੂੰ ਅਤੇ ਰਾਤ ਵਾਸਤੇ ਉਹਨਾਂ ਨੂੰ ਪਾਣੀ ਡਾ ਕੇ ਅਤੇ ਉਹਨਾਂ ਨੂੰ ਵਾਪਸ ਅੰਦਰ ਕਰ ਜਾਣਾ ਤਾਂ ਕਿ ਉਹ ਕਿਤੇ ਜਾ ਉਹ ਜਾ ਨਾ ਸਕਣ ਅਤੇ ਸੇਫ ਰਹਿਣ ਸਹੀ ਰਹਿਣ ਜਿੱਦਾਂ ਜੇਕਰ ਪਸ਼ੂ ਦੇ ਕੋਈ ਬਿਮਾਰੀ ਹੁੰਦੀ ਹੈ ਜਾਂ ਕੁਛ ਵੀ ਹੁੰਦਾ ਹਫਤਾਵਾਰੀ ਮਹੀਨੇਵਾਰੀ ਜਿੱਦਾਂ ਕਿ ਕੁਛ ਉਹਨਾਂ ਵਿੱਚ ਟੀਕਾਕਰਨ ਜ਼ਰੂਰਤ ਤਾਂ ਟੀਕਾਕਰਨ ਕਰਾਇਆ ਜਾਂਦਾ ਅਤੇ ਹੋਰ ਕੁਛ ਜੇਕਰ ਉਹ ਚਾਰਾ ਨਹੀਂ ਖਾ ਰਹੇ ਅਤੇ ਹੋਰ ਫਿਰ ਹਕੀਮਾਂ ਨੂੰ ਵਿਖਾਇਆ ਜਾਂਦਾ